ਜਦੋਂ ਸਾਡੇ ਕੋਲ ਪੇਂਟਿੰਗ ਕਰਨ ਲਈ ਕੋਈ ਵਿਸ਼ਾ ਜਾਂ ਥੀਮ ਹੁੰਦੀ ਹੈ ਤਾਂ ਪੇਂਟਿੰਗ ਕਰਨੀ ਹੋਰ ਵੀ ਆਸਾਨ ਹੋ ਜਾਂਦੀ ਹੈ ਬਸ ਆਪਣੀ ਅੰ ਅਪ ਆਪਣੀਆਂ ਅੱਖਾਂ ਬੰਦ ਕਰੋ ਅਤੇ ਅੰਤਰ ਆਤਮਾ ਵਿੱਚ ਜੋ ਵੀ ਤੁਹਾਨੂੰ ਦਿਖਾਈ ਦਿੰਦਾ ਹੈ ਉਸਨੂੰ ਕਿਸੇ ਕਾਗਜ਼ ਉੱਤੇ ਪੇਂਟ ਕਰ ਦਿਉ